ਅਠਾਰ੍ਹਾਂ ਮਾਰਚ ਉੱਨੀ ਸੌ ਉਣਾਨਵੇਂ ਦਸ ਮਈ ਦੋ ਹਜ਼ਾਰ ਸੌਲ੍ਹਾਂ ਸਤਾਈ ਦਸੰਬਰ ਦੋ ਹਜ਼ਾਰ ਚੌਦ੍ਹਾਂ ਸਤੰਬਰ ਉੱਨੀ ਸੌ ਉਣਾਨਵੇਂ ਦਸ ਅਕਤੂਬਰ ਉੱਨੀ ਸੌ ਉਣਾਨਵੇਂ